ਸਤਿ ਸ਼੍ਰੀ ਅਕਾਲ ਜੀ ਮੈਂ ਕੀ ਮੇਰੀ ਗੱਲ ਸ਼ਿਵ ਮੋਟਰਜ਼ ਨਾਲ ਹੋ ਰਹੀ ਹੈ ਮੇਰਾ ਨਾਮ ਸਲੋਨੀ ਹੈ ਮੈਂ ਇੱਕ ਘੰਟਾ ਪਹਿਲਾਂ ਤੁਹਾਡੀ ਤੁਹਾਡੇ ਏਜੰਸੀ 'ਚੋਂ ਕੈਬ ਬੁੱਕ ਕੀਤੀ ਸੀ ਪਰ ਮੈਨੂੰ ਹੁਣ ਬਹੁਤ ਟਾਈਮ ਹੋ ਗਿਆ ਹੈ ਮੈਂ ਹੁਣ ਉਸ ਕੈਬ ਦੀ ਵੇਟ ਕਰ ਰਹੀ ਹਾਂ ਨਾ ਤਾਂ ਉਹ ਡਰਾਈਵਰ ਹੁਣ ਤੱਕ ਆਇਆ ਹੈ ਅਤੇ ਮੈਂ ਉਹਨੂੰ ਕਦੋਂ ਦੀ ਫੋਨ ਕਰ ਰਹੀ ਹਾਂ ਨਾ ਤਾਂ ਉਹ ਮੇਰਾ ਫੋਨ ਚੁੱਕਦਾ ਹੈ ਅਤੇ ਨਾ ਹੀ ਰਿ ਕੋਈ ਰਿਸਪੌਂਸ ਦੇ ਰਿਹਾ ਹੈ ਮੈਂ ਤਾਂ ਸੋਚਿਆ ਸੀ ਕਿ ਤੁਹਾਡੀ ਏਜੰਸੀ ਬਹੁਤ ਹੀ ਵਧੀਆ ਕੰਮ ਕਰਦੀ ਹੈ ਪਰ ਮੈਂ ਇਸ ਚੀਜ਼ ਤੋਂ ਬਹੁਤ ਹੀ ਨਾਖੁਸ਼ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਲਦ ਤੋਂ ਜਲਦ ਅਤੇ ਮੈਂ ਇੱਥੇ ਬਹੁਤ ਟਾਈਮ ਦੀ ਖੜ੍ਹੀ ਹਾਂ ਅਤੇ ਮੇਰੇ ਘਰਦੇ ਬਹੁਤ ਪ੍ਰੇਸ਼ਾਨ ਆ ਹੁਣ ਇਹ ਰਾਤ ਦੇ ਸਾਢੇ ਸੱਤ ਵੱਜੇ ਹੋਏ ਹਨ ਨਾ ਤਾਂ ਇਹ ਮੇਰੇ ਲਈ ਸੇਫ ਜਗ੍ਹਾ ਹੈ ਅਤੇ ਨਾ ਹੀ ਮੈਂ ਇੱਥੇ ਖੜ੍ਹਨਾ ਮੇਰਾ ਜ਼ਿਆਦਾ ਦੇਰ ਠੀਕ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਜਲਦ ਤੋਂ ਜਲਦ ਉਸ ਡਰਾਈਵਰ ਨੂੰ ਪੁੱਛੋ ਫੋਨ ਕਰਕੇ ਕਿ ਉਹ ਕਿੱਥੇ ਹੈ ਨਹੀਂ ਤਾਂ ਫਿਰ ਤੁਸੀਂ ਮੇਰੇ ਲਈ ਕੋਈ ਨਵਾਂ ਡਰਾਈਵਰ